ਹੈਲੋ ਕੀ ਸਾਡੀ ਗੱਲ ਸੇਤੀਆ ਹੋਟਲ 'ਤੇ ਹੋ ਰਹੀ ਹੈ ਅਸੀਂ ਕੱਲ੍ਹ ਤੁਹਾਨੂੰ ਔਡਰ ਦਿੱਤਾ ਸੀਗਾ ਕਿ ਸਾਡੇ ਘਰ ਖਾਣਾ ਪਹੁੰਚਾਇਆ ਜਾ ਜਾਵੇ ਅਸੀਂ ਕਈਆਂ ਦੇ ਕਹਿਣ 'ਤੇ ਤੁਹਾਨੂੰ ਔਡਰ ਕੀਤਾ ਸੀ ਵੀ ਸਾਨੂੰ ਤੁਹਾਡੀ ਬਹੁਤ ਮਤਲਬ ਸਾਰਿਆਂ ਨੇ ਤਾਰੀਫ਼ ਕੀਤੀ ਸੀ ਕਿ ਇਹਨਾਂ ਦਾ ਖਾਣਾ ਵਧੀਆ ਹੁੰਦਾ ਤਾਂ ਕਰਕੇ ਅਸੀਂ ਔਡਰ ਕਰ ਤਾ ਉਹਦੇ 'ਚ ਅਸੀਂ ਬੱਟ ਸਾਡੇ ਕਈ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਤਾਂ ਅਸੀਂ ਔਡਰ ਕੀਤਾ ਸੀਗਾ ਉਹਦੇ 'ਚ ਅਸੀਂ ਬੱਟਰ ਨਾਨ ਅੰਮ੍ਰਿਤਸਰੀ ਦਾਲ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਮੰਗਵਾਇਆ ਸੀਗਾ ਪਰ ਸ ਜਦੋਂ ਸ ਸਭ ਨੇ ਖਾਣਾ ਖਾਧਾ ਤਾਂ ਸਾਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਕਿਉਂਕਿ ਦਾਲ ਵੀ ਤੁਸੀਂ ਬੇਹੀ ਭੇਜ ਤੀ ਉਹਦੇ 'ਚੋਂ ਸਮੈਲ ਆ ਰਹੀ ਸੀ ਦਾਲ ਵਿੱਚੋਂ ਅਤੇ ਹੋਰ ਵੀ ਕਈ ਸਮਾਨਾਂ ਦਾ ਟੇਸਟ ਵਧੀਆ ਨਹੀਂ ਸੀ ਅਸੀਂ ਸਸ ਤੁਹਾਡੀ ਬਹੁਤ ਤਾਰੀਫ਼ ਸੁਣੀ ਸੀ ਅਤੇ ਅਸੀਂ ਤੁਹਾਡੇ 'ਤੇ ਵਿਸ਼ਵਾਸ ਕਰਕੇ ਹੀ ਸ ਸਾਰਾ ਕੁਛ ਖਾਣਾ ਮੰਗਵਾਇਆ ਸੀਗਾ ਪਰ ਸਾਨੂੰ ਪਤਾ ਨਹੀਂ ਸੀ ਕਿ ਸਾਨੂੰ ਇੰਨੀ ਸ਼ਰਮਿੰਦਗੀ ਮਹਿਸੂਸ ਹੋਏ ਅ ਕਰਨੀ ਪਏਗੀ ਅਤੇ ਤੁਹਾਡੀ ਪੈਕਜਿੰਗ ਵੀ ਵਧੀਆ ਨਹੀਂ ਸੀ ਜੀ ਠੰਡਾ ਖਾਣਾ ਤੁਸੀਂ ਭੇਜ ਤਾ ਹੈਗਾ ਤੁਸੀਂ ਆਪਣੀ ਪੈਕਿੰਗ ਹੀ ਵੀ ਸੁਧਾਰੋ ਕਿ ਜੇ ਤੁਸੀਂ ਜਾਂ ਤਾਂ ਤੁਸੀਂ ਸਾਨੂੰ ਪੈਸੇ ਵਾਪਸ ਕਰ ਦਿਓ ਜਾਂ ਫਿਰ ਤੁਸੀਂ ਸਾਨੂੰ ਵਧੀਆ ਫਰੈਸ਼ ਤਾਜ਼ਾ ਖਾਣਾ ਭੇਜੋ ਅਤੇ ਟੇਸਟ ਵੀ ਉਹਦਾ ਵਧੀਆ ਹੋਣਾ ਚਾਹੀਦਾ ਤਾਂ ਕਿ ਸਾਨੂੰ ਸਾਰੇ ਸਾਡੇ ਜਿਹੜੇ ਗੈਸਟ ਮਹਿਮਾਨ ਆਏ ਹੋਏ ਹਨ ਹਨ ਉਹਨਾਂ ਸਾਹਮਣੇ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਉਹ ਤੁਹਾਡੇ ਖਾਣੇ ਦੀ ਤਾਰੀਫ਼ ਕਰਨ ਤਾਂ ਕਿ ਅਸੀਂ ਅੱਗੇ ਤੋਂ ਵੀ ਤੁਹਾਨੂੰ ਔਡਰ ਕਰ ਸਕੀਏ